ਹਾਂਜੀ ਕੱਪੜੇ ਧੋਣ ਦੇ ਲਈ ਵੈਸੇ ਸਾਰੀਆਂ ਜਿਹੜੀਆਂ ਘਰ ਦੀਆਂ ਮਹਿਲਾਵਾਂ ਹੁੰਦੀਆਂ ਹਨ ਉਹ ਸਭ ਨੂੰ ਕੱਪੜੇ ਧੋਣੇ ਹੀ ਪੈਂਦੇ ਹਨ ਕਿਉਂਕਿ ਇਹਨਾਂ ਨੂੰ ਧੋਏ ਬਿਨਾ ਤਾਂ ਸਰਦਾ ਨਹੀਂ ਹੈ ਅਸੀਂ ਵੈਸੇ ਤਾਂ ਅਸੀਂ ਕੱਪੜੇ ਜਿਹੜੇ ਹੈਗੇ ਆ ਆਪਣੀ ਵਾਸ਼ਿੰਗ ਮਸ਼ੀਨ ਵਿੱਚ ਹੀ ਧੋਂਦੇ ਹਾਂ ਰੋਟੀਨ ਵਾਈਜ ਲੇਕਿਨ ਕਦੇ ਕਦੇ ਕੀ ਹੁੰਦਾ ਹੈ ਕਿ ਲਾਈਟ ਨਹੀਂ ਹੁੰਦੀ ਤਾਂ ਸਾਨੂੰ ਫਿਰ ਆਪਣੇ ਕੱਪੜੇ ਜਿਹੜੇ ਹੈਗੇ ਆ ਹੱਥ ਨਾਲ ਵੀ ਧੋਣੇ ਪੈਂਦੇ ਹਨ ਵੈਸੇ ਮਸ਼ੀਨ ਦੇ ਵਿੱਚ ਜਲਦੀ ਸੁੱਕ ਜਾਂਦੇ ਹਨ ਲੇਕਿਨ ਜਦੋ ਕਦੇ ਲਾਈਟ ਨਾ ਹੋਵੇ ਬਾਰਿਸ਼ ਹੋਵੇ ਤਾਂ ਸਾਨੂੰ ਫੇਰ ਕੱਪੜੇ ਸੁਕਾਉਣ ਦੇ ਵਿੱਚ ਥੋੜ੍ਹੀ ਜਿਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸਦੇ ਲਈ ਅਸੀਂ ਫੇਰ ਕੱਪੜੇ ਜਿਹੜੇ ਹੈਗੇ ਆ ਕੱਪੜੇ ਸੁਕਾਉਣ ਵਾਲੇ ਇੱਕ ਸਟੈਂਡ 'ਤੇ ਪਾ ਕੇ ਅੰਦਰ ਆਪਣੇ ਕਮਰੇ ਦੇ ਵਿੱਚ ਪੱਖੇ ਦੇ ਨਿੱਚੇ ਅਸੀਂ ਰੱਖ ਲੈਂਦੇ ਹਾਂ ਤਾਂ ਉੱਥੇ ਉਹਨਾਂ ਨੂੰ ਹਵਾ ਲੱਗਦੀ ਰਹਿੰਦੀ ਹੈ ਅਤੇ ਉੱਥੇ ਉਹ ਸੁੱਕ ਜਾਂਦੇ ਆ